ਹੈਲੋ ਮੈਨੇਜਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਜ਼ਰੂਰੀ ਮੀਟਿੰਗ ਵਿੱਚ ਬੈਠੀ ਹਾਂ ਅਤੇ ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਮੇਰਾ ਬੈ ਬੈਲੈਂਸ ਨਾ ਘੱਟ ਹੈ ਅਤੇ ਪਲੀਜ਼ ਤੁਸੀਂ ਛੇਤੀ ਤੋਂ ਛੇਤੀ ਰੀਚਾਰਜ ਕਰਵਾ ਦਿਓ ਢਾਈ ਸੌ ਰੁਪਏ ਵਾਲਾ ਜਿਹੜਾ ਮਹੀਨੇ ਦਾ ਹੁੰਦਾ ਉਹ ਹੁਣ ਤੁਹਾਨੂੰ ਪੈਸੇ ਨਾ ਬਾਅਦ 'ਚੋਂ ਭੇਜ ਦਾਂਗੀ ਪਲੀਜ ਥੋੜ੍ਹਾ ਛੇਤੀ ਕਰਵਾ ਦਿਓ ਅਤੇ ਨੰਬਰ ਲਿਖੋ ਨੜਿਨਵੇਂ ਇੱਕ ਪੰਨਤਾਲੀ ਪੈਂਹਠ ਚਾਰ ਸਤਾਨਵੇਂ ਧੰਨਵਾਦ